ਬਾਗਬਾਨੀ ਰੂਟੀਨ ਵਿੱਚ ਕੰਪੋਸਟਿੰਗ ਦੀ ਭੂਮਿਕਾ ਕੰਪੋਸਟਿੰਗ ਡੀਕਲੇਟੇਸ਼ਨ ਦੀ ਮਾਈਕਰੋਬਾਲ ਪ੍ਰਕਿਰਿਆ ਹੈ ਜਿਸ ਵਿੱਚ ਜੈਵਿਕ ਖਾਦ ਪੈਦਾ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਰਹਿੰਦ ਖੂੰਹਦ ਨੂੰ ਕੁਦਰਤੀ ਤੌਰ 'ਤੇ ਘਟਾਇਆ ਜਾਂਦਾ ਹੈ ਇਸ ਵਿੱਚ ਗਲੇ ਸੜੇ ਪੋ ਪੌਦੇ ਜਾਨਵਰ ਹੋ ਗਏ ਜਿਹੜੇ ਮਰੇ ਹੁੰਦੇ ਆ ਉਹਨਾਂ ਨੂੰ ਕੁਦਰਤੀ ਤੌਰ 'ਤੇ ਘਟਾਇਆ ਜਾਂਦਾ ਹੈ ਅਤੇ ਜੈਵਿਕ ਖਾਦ ਪੈਦਾ ਕੀਤੀ ਜਾਂਦੀ ਹੈ ਜੈਵਿਕ ਖਾਦ ਦੀ ਵਰਤੋਂ ਮਿੱਟੀ ਦੇ ਸੰਸ਼ੋਧਨ ਲਈ ਕੀਤੀ ਜਾਂਦੀ ਹੈ ਜੋ ਪੌਦਿਆਂ ਦੇ ਵਾਧੇ ਵਿੱਚ ਮਦਦ ਕਰਦੀ ਹੈ ਇਸ ਵਿੱਚ ਬੈਕਟੀਰੀਆ ਦੀ ਫੰਜਾਈ ਦੀ ਮੌਜੂਦਗੀ ਇਹ ਸਭ ਕੁੱਝ ਬੈਕਟੀਰੀਆ ਦੀ ਫੰਜਾਈ ਦੀ ਮੌਜੂਦਗੀ ਵਿੱਚ ਵਾਪਰਦਾ ਹੈ ਜਿਸ ਨਾਲ ਬਾਗਬਾਨੀ ਵਿੱਚ ਕੰਪੋਸਟਿੰਗ ਦੀ ਭੂਮਿਕਾ ਨਿਭਾਈ ਜਾਂਦੀ ਹੈ